ਪੰਜਾਬ ਵਿੱਚ ਚਾਇਲ ਲੇਬਰ ਨੂੰ ਲੈ ਕੇ ਬਹੁਤ ਜ਼ਿਆਦਾ ਕਾਨੂੰਨ ਬਣਾਏ ਗਏ ਹਨ ਤਾਂ ਮਿਨੀਮਮ ਵੇਜ਼ ਨੂੰ ਲੈ ਕੇ ਕਿ ਔਰਤਾਂ ਨੂੰ ਜਿਹੜਾ ਅ ਮਿਨੀਮਮ ਵੇਜ ਰੇਟ ਆ ਉਹ ਬਹੁਤ ਜ਼ਿਆਦਾ ਘੱਟ ਹੈ ਐਜ਼ ਕੰਪੇਅਰ ਟੂ ਮੈਨ ਤਾਂ ਉਹਦੇ ਨਾਲ ਰਿਲੇਟਡ ਭਾਰਤ ਵਿੱਚ ਬਹੁਤ ਜ਼ਿਆਦਾ ਕਾਨੂੰਨ ਬਣਾਏ ਗਏ ਹਨ ਪਰ ਕੀ ਇਹਨਾਂ ਕਾਨੂੰਨਾਂ ਨੂੰ ਲਾਗੂ ਕੀਤਾ ਜਾ ਰਿਹਾ ਕਿ ਇਹਨਾਂ ਦਾ ਪੂਰੀ ਤਰ੍ਹਾਂ ਅਤੇ ਇਨਫੋਰਸਮੈਂਟ ਹੋ ਰਿਹਾ ਨਹੀਂ ਹੋ ਰਿਹਾ ਕਿਉਂਕਿ ਅੱਜ ਵੀ ਜੇਕਰ ਤੁਸੀਂ ਦੇਖੋਗੇ ਤਾਂ ਪਿੰਡਾਂ ਦੇ ਵਿੱਚ ਚਾਇਲਡ ਲੇਬਰ ਹੁੰਦੀ ਹੈ ਪੰਜਾਬ ਵਿੱਚ ਕਾਨੂੰਨ ਹਨ ਪਰ ਉਹਨਾਂ ਨੂੰ ਪ੍ਰੋਪਰ ਤਰ੍ਹਾਂ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਹੈ ਜੇਕਰ ਕਿਸੇ ਜਗ੍ਹਾ 'ਤੇ ਲਾਗੂ ਵੀ ਕੀਤਾ ਜਾਂਦਾ ਹੈ ਕਿ ਚੌਦਾਂ ਸਾਲ ਤੋਂ ਘੱਟ ਬੱਚੇ ਕੰਮ ਨਹੀਂ ਕਰ ਸਕਦੇ ਪਰ ਅੱਗੇ ਵਾਸਤੇ ਉਹਨਾਂ ਨੂੰ ਉਹਨਾਂ ਦੀ ਡੇਲੀ ਦਾ ਭੋਜਨ ਪ੍ਰਾਪਤ ਪ੍ਰਦਾਨ ਨਹੀਂ ਕਰਵਾਇਆ ਜਾ ਰਿਹਾ ਉਹਨਾਂ ਦੀ ਫੈਮਿਲੀਜ਼ ਨੂੰ ਪ੍ਰੋਪਰ ਵੇਜ਼ਿਜ਼ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਇਸ ਤਰ੍ਹਾਂ ਪੰਜਾਬ ਵਿੱਚ ਕਾਨੂੰਨ ਹਨ ਪਰ ਉਹਨਾਂ ਨੂੰ ਪ੍ਰੋਪਰ ਤਰ੍ਹਾਂ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਪ੍ਰੋਪਰ ਤਰ੍ਹਾਂ ਨਾਲ ਉਹਨਾਂ ਦਾ ਉਹਨਾਂ ਦੀਆਂ ਪ੍ਰੋਬਲਮ ਦਾ ਹੱਲ ਨਹੀਂ ਕੀਤਾ ਜਾ ਰਿਹਾ